ਸਤਿ ਸ਼੍ਰੀ ਅਕਾਲ ਜੀ ਮੈਂ ਬਚਪਨ ਤੋਂ ਹੀ ਇਤਿਹਾਸ ਦੇ ਬਾਰੇ ਪੜ੍ਹਦੀ ਅਤੇ ਸੁਣਦੀ ਆਈ ਹਾਂ ਮੈਂ ਬਹੁਤ ਸਾਰੀਆਂ ਇਤਿਹਾਸਿਕ ਕਹਾਣੀਆਂ ਪੜ੍ਹੀਆਂ ਅਤੇ ਸੁਣੀਆਂ ਹਨ ਇਤਿਹਾਸ ਮੇਰਾ ਮਨਪਸੰਦ ਵਿਸ਼ਾ ਵੀ ਰਿਹਾ ਹੈ ਇਤਿਹਾਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੈ ਮੇਰੀ ਜੋ ਮਨਪਸੰਦ ਇਤਿਹਾਸਿਕ ਕਹਾਣੀ ਹੈ ਉਹ ਡੋਕਟਰ ਭੀਮ ਰਾਓ ਅੰਬੇਦਕਰ ਜੀ ਦੀ ਹੈ ਡੋਕਟਰ ਭੀਮ ਰਾਓ ਅੰਬੇਦਕਰ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਹਨਾਂ ਦਾ ਜਨਮ ਚੌਦਾਂ ਅਪ੍ਰੈਲ ਅਠਾਰਾਂ ਸੌ ਇਕਾਨਵੇਂ ਈਸਵੀ ਨੂੰ ਹੋਇਆ ਉਹ ਇੱਕ ਦਲਿਤ ਪਰਿਵਾਰ ਦੇ ਵਿੱਚ ਪੈਦਾ ਹੋਏ ਉਹਨਾਂ ਨੂੰ ਅਛੂਤ ਸਮਝਿਆ ਜਾਂਦਾ ਸੀ ਉਹ ਜਾਤ ਪਾਤ ਦੇ ਖਿਲਾਫ ਲੜੇ ਉਹਨਾਂ ਨੂੰ ਵਿੱਦਿਆ ਹਾਸਲ ਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਕਦੀ ਵੀ ਹਾਰ ਨਹੀਂ ਮੰਨੀ ਉਹਨਾਂ ਨੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਡੋਕਟਰੇਟ ਦੀ ਡਿਗਰੀ ਹਾਸਲ ਕੀਤੀ ਉਹ ਹਮੇਸ਼ਾ ਹੀ ਦਲਿਤਾਂ ਗਰੀਬਾਂ ਅਤੇ ਲੋੜਵੰਦਾਂ ਦੇ ਹੱਕਾਂ ਦੇ ਸਮਰਥਨ ਦੇ ਵਿੱਚ ਰਹੇ ਹਨ ਉਹ ਸਾਡੇ ਸੰਵਿਧਾਨ ਦੇ ਰਚਣਹਾਰੇ ਸਨ ਉਹ ਮਹਾਨ ਦਾਰਸ਼ਨਿਕ ਸਨ ਉਹਨਾਂ ਦੇ ਸਿਧਾਂਤ ਅੱਜ ਵੀ ਸਾਡੇ ਦੇਸ਼ ਦੇ ਵਿੱਚ ਲਾਗੂ ਹਨ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਵੀ ਉਹਨਾਂ ਨੇ ਕਦੇ ਲੜਨਾ ਨਹੀਂ ਛੱਡਿਆ ਉਹਨਾਂ ਨੇ ਹਮੇਸ਼ਾ ਹੀ ਜਾਤ ਪਾਤ ਛੂਆ ਛਾਤ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ ਅਤੇ ਲੋੜਵੰਦਾਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਦਿਵਾਏ ਮੈਨੂੰ ਉਹਨਾਂ ਦੀ ਜੀਵਨੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਕਿ ਅਨੇਕਾਂ ਮੁਸ਼ਕਲਾਂ ਆਉਂਦੇ ਹੋਏ ਵੀ ਤੁਸੀਂ ਕਦੇ ਹਾਰ ਨਾ ਮੰਨੋ ਬਲਕਿ ਆਉਣ ਵਾਲੀਆਂ ਮੁਸ਼ਕਲਾਂ ਦਾ ਮੁਸ਼ਕਲਾਂ ਦਾ ਡੱਟ ਕੇ ਸਾਹਮਣਾ ਕਰੋ ਧੰਨਵਾਦ ਜੀ